ਹੈਲੋ ਡਾਕਟਰ ਸਾਹਿਬ ਯਾਰ ਮੇਰਾ ਢਿੱਡ ਬਹੁਤ ਦੁੱਖਦਾ ਕੀ ਕਰਾਂ ਮੈਂ ਡਾਕਟਰ ਸਾਹਬ ਸਪੈਸ਼ਲੀ ਮੈਨੇ ਤੁਹਾਨੂੰ ਬੋਲਿਆ ਕਿ ਤੁਹਾਡੀ ਪੇਟ 'ਚ ਇੰਨਫੈਕਸ਼ਨ ਹੈਗੀ ਤੁਸੀਂ ਬਾਹਰ ਦਾ ਘੱਟ ਖਾਣਾ ਤੁਸੀਂ ਬਾਹਰ ਦਾ ਘੱਟ ਖਾਣਾ ਡਾਕਟਰ ਸਾਹਿਬ ਉਹੀ ਤਾਂ ਨਹੀਂ ਰੁਕਿਆ ਜਾਂਦਾ ਪਿਆ ਕੀ ਕਰਾਂ ਜੁਬਾਨ ਦਾ ਟੇਸਟ ਨਹੀਂ ਮੁੱਕਦਾ ਪਿਆ ਮੇਰਾ ਤੇ ਉਹੀ ਡਾਕਟਰ ਸਾਹਿਬ ਮੈਂ ਤੁਹਾਨੂੰ ਕੀ ਦੱਸਾ ਘਰ ਦੀਆਂ ਚੀਜ਼ਾਂ ਖਾ ਕੇ ਤੇ ਮੇਰਾ ਢਿੱਡ ਹੋਰ ਦੁਖੀ ਜਾਂਦਾ ਵੈ ਡਾਕਟਰ ਸਾਹਿਬ ਦੇ ਨਮਕ ਹੈ ਨਮਕ ਬੜੀ ਸਿੱਧਾ ਖਾ ਕੇ ਤੇ ਮੇਰਾ ਪਿੰਡ ਦਾ ਗਧ ਹੋਣ ਲੱਗ ਜਾਂਦਾ ਮੈਨੂੰ ਮਸਾਲੇ ਵਾਲੀ ਚੀਜ਼ਾਂ ਪਸੰਦ ਹੈ ਠੀਕ ਹੈ ਡਾਕਟਰ ਸਾਹਿਬ ਬੇਟਾ ਤੁਸੀਂ ਪੂਰੀ ਤਰ੍ਹਾਂ ਸੀ ਮੇਰਾ ਠੀਕ ਹੋ ਜਾਵਾਂਗੀ ਨਹੀਂ ਠੀਕ ਹੈ ਡਾਕਟਰ ਸਾਹਿਬ ਨੇ ਹੁਣ ਇਹੀ ਕਰਾਂਗੀ ਤੇ ਮੈਂ ਦੋ ਦਿਨ ਬਾਅਦ ਅਕਰਮ ਦੱਸਾਂਗੀ ਦੋ ਦਿਨ ਬਾਅਦ ਡਾਕਟਰ ਸਾਹਿਬ ਹੁਣ ਸਾਰੀ ਗੱਲਾਂ ਮੰਨਾਗੇ ਢਿੱਡ ਦਾ ਦਰਦ ਵੀ ਠੀਕ ਹੋ ਜਾਊਗਾ ਇਹੀ ਉਮੀਦ ਕਰਦੀ ਮੈਂ ਤੁਹਾਡੇ ਕੋਲ ਠੀਕ ਹ ਡਾਕਟਰ ਸਾਹਿਬ ਮੈਂ ਹੁਣ ਆਹੀ ਕਰਾਂਗੀ ਮੈਂ ਬਾਲਾ ਕੁਛ ਵੀ ਨਹੀਂ ਖਾਵਾਂਗੀ ਘਰ ਦੀਆਂ ਹੀ ਸਬਜੀਆਂ ਉਬਾਲੀਆਂ ਹੋਈਆਂ ਖਾਵਾਂਗੀ ਤੇ ਯੋਗਾ ਵੀ ਕਰਾਂ ਠੀਕ ਹੈ ਡਾਕਟਰ ਸਾਹਿਬ ਆਹੀ ਕਰਾਂਗੀ ਇਕ ਡਾਕਟਰ ਸਾਹਿਬ ਮੈਂ ਦੋ ਦਿਨ ਬਾਅਦ ਆਵਾਂਗੀ ਡਾਕਟਰ ਸਾਹਿਬ ਡਾਕਟਰ ਸਾਹਬ ਜੋ ਤੁਸੀਂ ਕਿਹਾ ਸੀ ਮੈਂ ਉਹੀ ਕੀਤਾ ਮੇਰੇ ਚ ਦਰਦ ਹੁਣ ਠੀਕ ਹੋ ਗਿਆ ਠੀਕ ਐ ਡਾਕਟਰ ਸਾਹਿਬ ਅੱਜ ਤੋਂ ਆ ਹੀ ਹੁਣ ਤਾਂ ਮੈਂ ਬਹੁਤ ਜਿਆਦਾ ਤੰਦਰੁਸਤ ਹੋ ਗਈ ਆ ਠੀਕ ਹੈ ਡਾਕਟਰ ਸਾਹਿਬ